ਅਤੇ ਰਨਿੰਗ ਨਾਲ ਮੈਂ ਫਿਟ ਰਹਿੰਦੀ ਹੁੰਦੀ ਤੀ ਅਤੇ ਰਨਿੰਗ ਕਰਕੇ ਮੈਂ ਆਪਣਾ ਮਾਇੰਡ ਫਰੈਸ਼ ਰੱਖਦੀ ਹਾਂ ਅਤੇ ਮੈਨੂੰ ਹੁਣ ਕਿਸੇ ਕਿਸੇ ਚੀਜ਼ ਦੀ ਮਤਲਬ ਟੈਨਸ਼ਨ ਨਹੀਂ ਹੁੰਦੀ ਅਤੇ ਮੈਂ ਕਾਫੀ ਵਰਕਆਊਟ ਵੀ ਕਰ ਲੈਂਦੀ ਹਾਂ ਅਤੇ ਜਿਹੜਾ ਆਹ ਸਪਿਰਿਟ ਦੌੜ ਹੈ ਇਹ ਮੈਨੂੰ ਬਹੁਤ ਹੀ ਵਧੀਆ ਬਣਾਇਆ ਇਹਨੇ ਅਤੇ ਦੌੜਨ ਕਰਕੇ ਮੈਂ ਹੁਣ ਬਹੁਤ ਹੀ ਜ਼ਿਆਦਾ ਤੰਦਰੁਸਤ ਬਣ ਗਈ ਅਤੇ ਮੈਨੂੰ ਰਨਿੰਗ ਬਹੁਤ ਹੀ ਜ਼ਿਆਦਾ ਪਸੰਦ ਹੈ